ਲੋਕਾਂ ਨੂੰ ਆਪਣੇ ਰਾਜ ਦੇ ਭੂਗੋਲ ਬਾਰੇ ਪਤਾ ਹੋਣਾ ਜ਼ਰੂਰੀ ਹੈ ਜਿਸ ਦੇ ਨਾਲ ਉਹ ਕੁਦਰਤ ਰਹੀ ਕੁਦਰਤ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਚੰਗੀ ਤਰ੍ਹਾਂ ਜਾਣ ਸਕਦੇ ਹਨ ਅਤੇ ਕਿਤੇ ਵੀ ਅਗਰ ਉਹ ਘੁੰਮਣ ਜਾਂਦੇ ਹਨ ਤਾਂ ਉਹਨਾਂ ਨੂੰ ਉਸ ਰਾਜ ਦੇ ਭੂਗੋਲ ਬਾਰੇ ਵਾਤਾਵਰਨ ਬਾਰੇ ਪਤਾ ਹੋਣਾ ਜ਼ਰੂਰੀ ਹੈ ਜਿਸ ਦੇ ਨਾਲ ਉਹ ਆਪਣੀ ਇਸ ਯਾਤਰਾ ਨੂੰ ਹੋਰ ਵੀ ਆਸਾਨ ਬਣਾ ਸਕਦੇ ਹਨ ਉਹਨਾਂ ਨੂੰ ਆਪਣੇ ਰਾਜ ਬਾਰੇ ਉਹਨਾਂ ਦੇ ਵਾਤਾਵਰਨ ਮੌਸਮ ਮੀਂਹ ਪੈਣ ਦਾ ਸਹੀ ਸਮਾਂ ਫਸਲ ਉੱਗਣ ਦਾ ਸਹੀ ਸਮਾਂ ਅਤੇ ਹੋਰ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਅਗਰ ਉਹਨਾਂ ਨੂੰ ਰਾਜ ਦੇ ਭੂਗੋਲ ਬਾਰੇ ਪਤਾ ਹੋਵੇਗਾ ਤਾਂ ਹੀ ਉਹ ਸਹੀ ਫਸਲਾਂ ਉਗਾ ਸਕਦੇ ਹਨ ਅਤੇ ਖੇਤੀਬਾੜੀ ਕਰ ਸਕਦੇ ਹਨ ਜਿਸ ਦੇ ਨਾਲ ਹੀ ਰਾਜ ਦੀ ਆਰਥਿਕਤਾ ਵਿੱਚ ਵਿਕਾਸ ਹੋ ਸਕਦਾ ਹੈ ਰਾਜ ਦੇ ਭੂਗੋਲ ਦੇ ਨਾਲ ਸਾਡੇ ਦੇਸ਼ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ